ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਮਿਨਾਕਸ਼ੀ ਪਠਾਨਕੋਟ ਤੋਂ ਬੋਲ ਰਹੀ ਹਾਂ ਕਿ ਸਾਡੇ ਪਿੰਡ ਵਿੱਚ ਕਈ ਤਰ੍ਹਾਂ ਦੇ ਛੋਟੇ ਮੋਟੇ ਕਾਰੋਬਾਰ ਹਨ ਜੋ ਕਿ ਲੋਕਾਂ ਨੇ ਘਰਾਂ ਵਿੱਚ ਹੀ ਖੋਲ੍ਹੇ ਹੋਏ ਹਨ ਜਿਵੇਂ ਕਿ ਕਈ ਲੋਕਾਂ ਨੇ ਗਾਈਆਂ ਵਾਂ ਗਾਈਆਂ ਮੱਝਾਂ ਵਗੈਰਾ ਰੱਖੀਆਂ ਹਨ ਜੋ ਕਿ ਡੇਅਰੀਆਂ ਖੋਲ੍ਹ ਲੈਂਦੇ ਹਨ ਅਤੇ ਦੁੱਧ ਪਨੀਰ ਆਦਿ ਦਾ ਕਾਰੋਬਾਰ ਛੋਟਾ ਮੋਟਾ ਕਾਰੋਬਾਰ ਚਲਾ ਲੈਂਦੇ ਹਨ ਅਤੇ ਕਈ ਕਈ ਜਿਵੇਂ ਕਿ ਸਿਲਾਈ ਜੋ ਕਿ ਘਰਾਂ 'ਚ ਕੁੜੀਆਂ ਸਿਲਾਈ ਕਰਦੀਆਂ ਹਨ ਉਹ ਬੁਟੀਕ ਖੋਲ੍ਹ ਲੈਂਦੀਆਂ ਹਨ ਅਤੇ ਜੋ ਪਾਰਲਰ ਦਾ ਕਰਦੀਆਂ ਹਨ ਅਤੇ ਉਹ ਪਾਰਲਰ ਖੋਲ੍ਹ ਲੈਂਦੀਆਂ ਹਨ ਅਤੇ ਪਾਰਲਰ ਵਗੈਰਾ ਖੋਲ੍ਹ ਲੈਂਦੀਆਂ ਹਨ ਅਤੇ ਪਿੰਡ ਵਿੱਚ ਕਈ ਜਨਾਨੀਆਂ ਜੋ ਵੀ ਘਰਾਂ 'ਚ ਸਾਰਾ ਦਿਨ ਵਿਹਲੀਆਂ ਹੁੰਦੀਆਂ ਹਨ ਕਈ ਛਾਲ ਚੁੰਨੀਆਂ ਵਗੈਰਾ ਆਦਿ ਕੱਢ ਲੈਂਦੀਆਂ ਹਨ ਜੋ ਕਿ ਵਿਹਲਾ ਟਾਈਮ ਬਿਤਾਇਆ ਜਾ ਸਕੇ ਅਤੇ ਕਾਰੋਬਾਰ ਹੋ ਜਾਂਦਾ ਹੈ ਅਤੇ ਜੇਕਰ ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ ਸ਼ਿਲ ਸਿਲਾਈ ਦਾ ਬਹੁਤ ਸ਼ੌਕ ਹੈ ਜੋ ਕਿ ਸਿਲਾਈ ਕਰਨ ਵਿਹਲੇ ਟਾਈਮ ਵਿੱਚ ਸਿਲਾਈ ਨਾਲ ਟਾਈਮ ਪਾਸ ਕੀਤਾ ਜਾਂਦਾ ਹੈ ਅਤੇ ਘਰ ਵਿੱਚ ਇੱਕ ਛੋਟਾ ਜਿਹਾ ਬੁਟੀਕ ਖੋਲ੍ਹਿਆ ਹੈ